ਖਾਣਾ ਬਣਾਉਣ ਲਈ ਜੜ੍ਹੀਆਂ ਬੂਟੀਆਂ ਦੀ ਵਰਤੋਂ ਸਿਹਤ ਪੱਖ ਨੂੰ ਦੇਖਦੇ ਹੋਏ ਕਾਫੀ ਬਿਹਤਰ ਹੈ ਜੋ ਜੜ੍ਹੀਆਂ ਬੂਟੀਆਂ ਖਾਣਾ ਬਣਾਉਣ 'ਚ ਵਰਤੀਆਂ ਜਾਂਦੀਆਂ ਹਨ ਉਹ ਕਿਸੇ ਨਿਆਮਤ ਤੋਂ ਘੱਟ ਨਹੀਂ ਸਵਾਦ ਦੇ ਨਾਲ ਨਾਲ ਸਿਹਤ ਪੱਖ ਨੂੰ ਵੀ ਵਧੀਆ ਰੱਖਦੀਆਂ ਹਨ ਜਿਹੜੀਆਂ ਜੜ੍ਹੀਆਂ ਬੂਟੀਆਂ ਜ਼ਿਆਦਾਤਰ ਮਸਾਲੇ ਵੀ ਆਪਾਂ ਜਿਹੜੇ ਵਰਤਦੇ ਹਾਂ ਉਹ ਜੜ੍ਹੀਆਂ ਰੂ ਬੂਟੀਆਂ ਦਾ ਹੀ ਰੂਪ ਹਨ ਅਤੇ ਮਸਾਲਿਆਂ ਵਿੱਚ ਕਾਫੀ ਜੜ੍ਹੀਆਂ ਬੂਟੀਆਂ ਦੀ ਵੀ ਵਰਤੋਂ ਹੁੰਦੀ ਹੈ ਸੌਂਫ ਕਾਲੀ ਮਿਰਚ ਤੋਂ ਇਲਾਵਾ ਛੋਟੀ ਇਲਾਇਚੀ ਆਦਿ ਇਹ ਜੜ੍ਹੀਆਂ ਬੂਟੀਆਂ ਦਾ ਹੀ ਰੂਪ ਹਨ